ਮੈਂ ਨਾ ਹੇਅਰ ਜੈਲਸ ਦੀ ਇੱਕ ਸੇਲ ਦੇਖੀ ਸੀ ਸੇਲ ਦੇ ਵਿੱਚੋਂ ਮੈਂ ਫਲਿੱਪਕਾਰਟ ਤੋਂ ਹੀ ਅਤੇ ਸੇਲ ਦੇ ਵਿੱਚੋਂ ਹੀ ਮੈਂ ਇੱਕ ਹੇਅਰ ਜੈੱਲ ਮੰਗਵਾਇਆ ਜਦੋਂ ਮੈਂ ਫਸਟ ਟਾਈਮ ਮੰਗਵਾਇਆ ਸੀ ਉਹ ਤਾਂ ਮੈਨੂੰ ਠੀਕ ਲੱਗਾ ਸੀ ਸੇਲ ਦੇ ਵਿੱਚ ਸੀ ਅਤੇ ਕਾਫ਼ੀ ਮੈਨੂੰ ਲੈੱਸ ਦੇ ਉੱਪਰ ਵੀ ਮਿਲ ਗਿਆ ਸੀਗਾ ਅਤੇ ਕਾਫ਼ੀ ਅੱਛਾ ਐਕਸਪੀਰੀਅੰਸ ਰਿਹਾ ਮੇਰਾ ਪਰ ਮੈਂ ਹੁਣ ਉਹ ਦੁਬਾਰਾ ਔਰਡਰ ਕੀਤਾ ਫਿਰ ਉੱਥੋਂ ਦੇਖ ਕੇ ਇੱਕ ਤਾਂ ਮੈਨੂੰ ਉਹਦਾ ਰੇਟ ਵੀ ਜ਼ਿਆਦਾ ਪੈ ਗਿਆ ਪਰ ਜਦੋਂ ਮੈਂ ਉਹਨੂੰ ਯੂਜ਼ ਕੀਤਾ ਚਲੋ ਰੇਟ ਦੀ ਵੀ ਕੋਈ ਗੱਲ ਨਹੀਂ ਹੈ ਪ੍ਰੋਡਕਟ ਅੱਛਾ ਹੋਣਾ ਚਾਹੀਦਾ ਆਪਣੇ ਲਈ ਬੈਨੀਫੀਸ਼ੀਅਲ ਹੋਣਾ ਚਾਹੀਦਾ ਪਰ ਜਦੋਂ ਮੈਂ ਉਹਨੂੰ ਯੂਜ਼ ਕੀਤਾ ਪਰ ਉਹਦਾ ਉਹ ਰਿਜ਼ਲਟ ਨਹੀਂ ਆਇਆ ਜੋ ਮੇਰੇ ਫਸਟ ਪ੍ਰੋਡਕਟ 'ਤੇ ਆਇਆ ਸੀਗਾ ਫਸਟ ਵਾਲਾ ਬਹੁਤ ਵਧੀਆ ਰਿਹਾ ਸੀ ਮੇਰੇ ਵਾਲ ਬਹੁਤ ਅੱਛੇ ਹੋ ਗਏ ਸੀ ਬੜੇ ਸਮੂਥ ਸਿਲਕੀ ਹੋ ਗਏ ਸੀ ਪਰ ਇਹ ਸੈਕਿੰਡ ਵਾਲਾ ਯੂਜ਼ ਕਰਨ ਤੋਂ ਬਾਅਦ ਮੇਰੇ ਵਾਲ ਇੱਕਦਮ ਬੜੇ ਰਫ਼ ਜਿਹੇ ਹੋ ਗਏ ਟੁੱਟਣੇ ਜਿਹੇ ਸ਼ੁਰੂ ਹੋ ਗਏ ਉਹ ਵਾਲਾ ਜਿਹੜਾ ਜੈੱਲ ਸੀ ਉਹ ਥੋੜ੍ਹਾ ਲਿਕੁਅਡ ਤਾਂ ਸੀ ਪਰ ਥੋੜ੍ਹਾ ਜਿਹਾ ਹਾਰਡ ਸੀ ਪਰ ਇਹ ਤਾਂ ਬਿਲਕੁਲ ਹੈ ਇਸ ਤਰ੍ਹਾਂ ਸੀ ਜਿਵੇਂ ਕਿ ਪਾਣੀ ਆ ਰਿਹਾ ਹੁੰਦਾ ਬੋਟਲ ਦੇ ਵਿੱਚੋਂ ਮੈਨੂੰ ਲੱਗਦਾ ਕਿ ਜਾਂ ਤਾਂ ਇਹ ਖ਼ਰਾਬ ਸੀਗਾ ਜੈੱਲ ਅਤੇ ਜਾਂ ਇਹ ਡੁਪਲੀਕੇਟ ਸੀ ਅਤੇ ਮੈਨੂੰ ਇਹ ਬਿਲਕੁਲ ਵੀ ਠੀਕ ਨਹੀਂ ਲੱਗਾ ਮੈਂ ਇਹਦੇ ਤੋਂ ਇਹਦਾ ਐਕਸਪੀਰੀਅੰਸ ਮੇਰੇ ਲਈ ਬਹੁਤ ਖ਼ਰਾਬ ਰਿਹਾ ਅਤੇ ਮੈਂ ਇਹ ਚਾਹੁੰਦੀ ਹਾਂ ਕਿ ਇਹ ਪ੍ਰੋਡਕਟ ਮੇਰਾ ਜਾਂ ਤਾਂ ਵਾਪਿਸ ਹੋ ਜਾਵੇ ਅਤੇ ਜਾਂ ਇਹਦੀ ਜਗ੍ਹਾ 'ਤੇ ਮੈਨੂੰ ਠੀਕ ਪ੍ਰੋਡਕਟ ਆ ਜਾਵੇ ਕਿਉਂਕਿ ਮੈਨੂੰ ਇਹ ਪਹਿਲਾਂ ਜਿਹੜਾ ਪ੍ਰੋਡਕਟ ਰਿਹਾ ਉਹ ਤਾਂ ਬਹੁਤ ਵਧੀਆ ਰਿਹਾ ਸੀ ਮੈਂ ਚਾਹੁੰਦੀ ਸੀ ਕਿ ਮੈਂ ਇਹਨੂੰ ਰੈਗੂਲਰ ਯੂਜ਼ ਕਰਾਂ